ਪਹਿਲਾਂ ਭਾਰਤੀ ਪੰਜਾਬੀ ਅਤੇ ਹਿੰਦੀ ਫਿਲਮਾਂ ਬਹੁਤ ਹੀ ਵਧੀਆ ਮੁੱਦਿਆਂ ਉੱਤੇ ਬਣਾਈਆਂ ਜਾਂਦੀਆਂ ਸੀ ਜਿਨ੍ਹਾਂ ਨੂੰ ਵੇਖ ਕੇ ਮਜਾ ਵੀ ਆਉਂਦਾ ਸੀ ਅਤੇ ਹਰ ਫਿਲਮ ਦਾ ਮੁੱਦਾ ਵੀ ਵੱਖਰਾ ਹੁੰਦਾ ਸੀ ਪਰ ਅੱਜ ਕੱਲ੍ਹ ਸਾਰੀਆਂ ਫਿਲਮਾਂ ਇੱਕੋ ਜਿਹੇ ਮੁੱਦਿਆਂ 'ਤੇ ਹੀ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕੁਝ ਕੁ ਤਾਂ ਨਿਰਾ ਲੱਚਰਪੁਣਾ ਹੀ ਹੁੰਦਾ ਹੈ ਮੈਨੂੰ ਤਾਂ ਪੰਜਾਬੀ ਕਮੇਡੀ ਫਿਲਮਾਂ ਵਧੀਆ ਲੱਗਦੀਆਂ ਹਨ ਜਿਨ੍ਹਾਂ ਨੂੰ ਅਸੀਂ ਸਾਰਾ ਟੱਬਰ ਇਕੱਠੇ ਬੈਠ ਕੇ ਵੇਖ ਸਕੀਏ ਮੈਨੂੰ ਜ਼ਿਆਦਾਤਰ ਐਮੀ ਵਿਰਕ ਦੀਆਂ ਫਿਲਮਾਂ ਅਤੇ ਗਾਣੇ ਪਸੰਦ ਹਨ ਉਹ ਵੀ ਇੱਕ ਬਹੁਤ ਹੀ ਵਧੀਆ ਗੀਤਕਾਰ ਹੈ ਇਸ ਤੋਂ ਬਿਨਾਂ ਮੈਨੂੰ ਬੀਬਾ ਨਿਰਮਲ ਰਿਸ਼ੀ ਦੀ ਅਦਾਕਾਰ ਬਹੁਤ ਪਸੰ ਬਹੁਤ ਪਸੰਦ ਹੈ ਉਹ ਵੀ ਆਪਣਾ ਹਰ ਰੋਲ ਬੜੇ ਹੀ ਅੜਬ ਤਰੀਕੇ ਨਾਲ ਪੇਸ਼ ਕਰਦੀ ਹੈ ਉਸਦੀਆਂ ਸਾਰੀਆਂ ਹੀ ਫਿਲਮਾਂ ਵੇਖ ਕੇ ਖੁਸ਼ੀ ਅਤੇ ਮਜਾ ਆਉਂਦਾ ਹੈ ਮੈਨੂੰ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ ਗਾਣਾ ਬਹੁਤ ਪਸੰਦ ਹੈ ਫਿਲਮ ਨੀ ਮੈਂ ਸੱਸ ਕੁੱਟਣੀ ਵੀ ਬੜੀ ਪਸੰਦ ਹੈ